ਹਾਂਜੀ ਜੇ ਆਪਾਂ ਗੱਲ ਕਰੀਏ ਭਾਰਤ ਦੀ ਸਿੱਖਿਆ ਪ੍ਰਣਾਲੀ ਇਹਦਾ ਇਸ ਵਿਸ਼ੇ ਦੇ ਉੱਪਰ ਹਰੇਕ ਬੰਦੇ ਦਾ ਅਲੱਗ ਰੁਝਾਨ ਆ ਅਲੱਗ ਉਹ ਆ ਸੋਚ ਪਹਿਲਾਂ ਘੱਟ ਪੜ੍ਹਿਆਂ ਲਿਖਿਆ ਨੂੰ ਵੀ ਜੋਬ ਮਿਲ ਜਾਂਦੀ ਸੀਗੀ ਨੌਕਰੀ ਮਿਲ ਜਾਂਦੀ ਸੀਗੀ ਦਸਵੀਂ ਪਾਸ ਪੜ੍ਹੇ ਹੋਏ ਬਹੁਤ ਤਕੜੇ ਤਕੜੇ ਉੱਚੇ ਉੱਚੇ ਅਹੁਦਿਆਂ 'ਤੇ ਪਹੁੰਚ ਜਾਂਦੇ ਸੀ ਪਰ ਹੁਣ ਕੀ ਆ ਹੁਣ ਸਿੱਖਿਆ ਪ੍ਰਣਾਲੀ ਦਾ ਬਹੁਤ ਜ਼ਿਆਦਾ ਪੱਧਰ ਵੱਧ ਗਿਆ ਅਤੇ ਉਵੇਂ ਹੀ ਨੌਕਰੀਆਂ ਦੀ ਘਾਟ ਪੈ ਗਈ ਕਿਉਂਕਿ ਪਾਪੂਲੇਸ਼ਨ ਵੱਧ ਗਈ ਅਤੇ ਹਰੇਕ ਬੰਦਾ ਕੋਂ ਇਗਜ਼ਾਮ ਦੇਣ ਵਾਲਾ ਕੋਈ ਨੌਕਰੀ ਹਾਸਲ ਕਰਨ ਵਾਸਤੇ ਉਸਨੂੰ ਕੋਈ ਨਾ ਕੋਈ ਕੋਂਪੀਟੇਟਿਵ ਇਗਜ਼ਾਮ ਦੇਣਾ ਪੈਂਦਾ ਉਸ ਦੀ ਫਿਰ ਮੈਰਿਟ ਬਹੁਤ ਵੱਧ ਜਾਂਦੀ ਆ ਹਰੇਕ ਬੱਚੇ ਨੂੰ ਜੋਬ ਨਹੀਂ ਮਿਲਦੀ ਉਸ ਤੋਂ ਬਾਅਦ ਫਿਰ ਇਸੇ ਕਰਕੇ ਬੱਚੇ ਬਾਹਰ ਜਾ ਰਹੇ ਆ ਆਪਣਾ ਇੱਧਰਲਾ ਸੱਭਿਆਚਾਰ ਛੱਡ ਕੇ ਸ ਇੱਧਰਲਾ ਸੱਭਿਆਚਾਰ ਪਰ ਇਹ ਚੀਜ਼ ਦਾ ਬਹੁਤ ਜ਼ਿਆਦਾ ਅਸਰ ਪੈ ਰਿਹਾ ਅਤੇ ਸਰਕਾਰ ਨੂੰ ਇਸ ਸਿੱਖਿਆ ਪ੍ਰਣਾਲੀ ਦਾ ਪੱਧਰ ਉੱਚਾ ਚੱਕਣ ਵਾਸਤੇ ਇਸ ਪਰ ਖਾਸ ਧਿਆਨ ਦੇਣ ਦੀ ਲੋੜ ਹੈ ਇਸ ਤਰਾਂ ਇਸ ਨਾਲ ਜੇ ਉਹ ਸਰਕਾਰ ਧਿਆਨ ਦਊਗੀ ਸਰਕਾਰ ਡੂੰਘਾਈ ਨਾਲ ਇਸ ਪਰ ਅਧਿਐਨ ਕਰੇਗੀ ਤਾਂ ਫਿਰ ਸਾਨੂੰ ਲੱਗਦਾ ਵੀ ਸ਼ਾਇਦ ਮਾੜੀ ਮੋਟਾ ਕੋਈ ਸੁਧਾਰ ਹੋ ਸਕੇ ਅਧਿਆਪਕ ਪੂਰੇ ਵਧੀਆ ਹੋਣੇ ਚਾਹੀਦੇ ਅਧਿਆਪਕਾਂ ਨੂੰ ਪੂਰੀ ਤਨਖਾਹ ਨਹੀਂ ਦਿੰਦੇ ਹੈਗੇ ਜਿਹੜੇ ਪ੍ਰਾਈਵੇਟ ਸਕੂਲ ਆ ਉਹ ਉਹਨਾਂ ਤੋਂ ਕੰਮ ਜ਼ਿਆਦਾ ਲੈਂਦੇ ਹਨ ਅਤੇ ਉਹਨਾਂ ਨੂੰ ਤਨਖਾਹ ਘੱਟ ਮਿਲਦੀ ਹੈ ਅਤੇ ਜਿਹੜੇ ਸਰਕਾਰੀ ਅਧਿਆਪਕ ਹਨ ਉਹਨਾਂ ਦੀ ਡਿਊਟੀਆਂ ਹੀ ਬਾਹਰ ਗੌਰਮੈਂਟ ਇੰਨੀਆਂ ਲਾ ਦਿੰਦੀ ਆ ਕਦੇ ਜਨਸੰਖਿਆ ਦਾ ਉਹਨਾਂ ਤੋਂ ਡਾਟਾ ਮੰਗਦੀ ਆ ਕਦੇ ਕੁਛ ਕਿਸੇ ਹੋਰ ਪਾਸੇ ਡਿਊਟੀ ਲਾ ਦੇ ਕਦੇ ਇਲੈਕਸ਼ਨ ਦੇ ਵਿੱਚ ਉਹਨਾਂ ਦੀ ਡਿਊਟੀ ਲਗਾ ਦਿੰਦੇ ਆ ਜੋ ਕਿ ਗਲਤ ਆ ਜਦ ਕਿ ਅਧਿਆਪਕ ਦਾ ਸਿਰਫ ਇੱਕੋ ਹੋਣਾ ਚਾਹੀਦਾ ਮ ਮੋਟੀਵ ਵੀ ਉਹ ਸਿਰਫ ਆਪਣੇ ਸਕੂਲ ਦੇ ਤੱਕ ਹੀ ਸੀਮਤ ਰਹੇ